ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਹਾਂਜੀ ਮੈਮ ਮੈਂ ਅਨਮੋਲਪ੍ਰੀਤ ਦੀ ਮੰਮਾ ਬੋਲ ਰਹੀ ਹਾਂ ਜੀ ਹਾਂਜੀ ਵਧੀਆ ਤੁਸੀਂ ਦੱਸੋ ਠੀਕ ਹੋ ਜੀ ਮੈਮ ਗੱਲ ਤਾਂ ਉਹਦੀ ਸਪੋਰਟਸ ਦੇ ਬਾਰੇ ਹੀ ਕਰਨੀ ਸੀਗੀ ਬੇਟਾ ਵੈਸੇ ਪੜ੍ਹਾਈ 'ਚ ਠੀਕ ਚੱਲ ਰਿਹਾ ਜੀ ਇਹਦੇ ਨਾਲ ਨਾਲ ਅਸੀਂ ਸੋਚ ਰਹੇ ਸੀ ਵੀ ਇਹ ਗੇਮਜ਼ ਬਾਰੇ ਵੀ ਇਹਦੀ ਸਪੋਰਟਸ ਇਵੈਂਟ ਜਿਹੜੇ ਨੇ ਉਹ ਕਦੋਂ ਤੋਂ ਚੱਲਣਗੇ ਵੀ ਇਹ ਪਾਰਟੀਸਪੇਟ ਵਗੈਰਾ ਅਸੀਂ ਇਹਦੇ ਕਰਵਾਉਣਾ ਚਾਹੁੰਦੇ ਸੀਗੇ ਮੈਮ ਵੈਸੇ ਤਾਂ ਇਹਨੂੰ ਅਸੀਂ ਜਿਹੜੀ ਪ੍ਰਾਈਵੇਟ ਕੋਚਿੰਗ ਦਵਾ ਰਹੇ ਹਾਂ ਉਹ ਫੈਂਸਿੰਗ ਦੇ ਰਿਗਾਰਡਿੰਗ ਇਹ ਹੈ ਫੈਂਸਿੰਗ ਕਰਵਾ ਰਹੇ ਹਾਂ ਅਸੀਂ ਇਹਨੂੰ ਹਾਂਜੀ

ਮੈਮ ਇਹ ਛੇ ਮਹੀਨੇ ਤੋਂ ਲਗਾਤਾਰ ਜਾ ਰਿਹਾ ਹੈ ਸੁਭਾਹ ਦੇ ਟਾਈਮ ਵੀ ਜਾਂਦਾ ਸ਼ਾਮ ਦੇ ਟਾਈਮ ਵੀ ਇਹਦੀ ਪ੍ਰੈਕਟਿਸ ਤਾਂ ਕਾਫੀ ਜ਼ਿਆਦਾ ਹੈ ਵੀ ਅਸੀਂ ਚਾਹੁੰਦੇ ਸੀ ਵੀ ਇਹ ਸਪੋਰਟਸ ਦੇ ਵਿੱਚ ਜਾ ਕੇ ਵੀ ਪਾਰਟੀਸਪੇਟ ਕਰੇ ਮੈਮ ਜਿਹੜੇ ਡੀ ਪੀ ਸਰ ਨੇ ਸਕੂਲ ਦੇ ਵੀ ਉਹ ਫਿਰ ਬੱਚਿਆਂ ਨੂੰ ਹਰ ਇੱਕ ਗੇਮ ਦੀ ਤਿਆਰੀ ਕਰਵਾਉਂਦੇ ਨੇ ਜੀ ਵੈਸੇ ਜਿਵੇਂ ਮੇਰਾ ਬੇਟਾ ਹਾਂਜੀ ਜਿਵੇਂ ਮੇਰਾ ਬੇਟਾ ਫੈਂਸਿੰਗ ਤਾਂ ਕਰ ਹੀ ਰਿਹਾ ਜੀ ਉਹਦੇ ਨਾਲ ਨਾਲ ਬੈਡਮਿੰਟਨ ਦੇ ਵਿੱਚ ਵੀ ਬਹੁਤ ਵਧੀਆ ਕਰਦਾ ਇਹ ਵੀ ਅਸੀਂ ਚਾਹੁੰਦੇ ਸੀ ਵੀ ਜੇ ਜਿਹੜੀ ਵੀ ਗੇਮ ਦੇ ਵਿੱਚ ਇਹ ਵਧੀਆ ਪਾਰਟੀਸਪੇਟ ਕਰਦਾ ਜਿਨ੍ਹਾਂ ਦੀ ਜੀ ਗਰੇਡਿੰਗ ਹੈਗੀ ਆ ਅਤੇ ਉਹ ਗੇਮਜ ਦੇ ਵਿੱਚ ਇਹ ਸਪੋਰਟਸ ਦੇ ਵਿੱਚ ਪਾਰਟੀਸਪੇਟ ਕਰ ਲਵੇ ਮੈਮ ਜਿਵੇਂ ਇਹਨਾਂ ਕੋਲ ਨਾ ਫੈਂਸਿੰਗ ਹੈ ਫੈਂਸਿੰਗ ਹੁਣ ਇਹਦਾ ਸਾਰੀ ਕਿੱਟ ਵਗੈਰਾ ਅਸੀਂ ਮੰਗਵਾ ਰੱਖੀ ਹੈ ਵੀ ਸਕੂਲ ਦੇ ਵਿੱਚ ਇਹਦੀ ਪ੍ਰੈਕਟਿਸ ਕਰਵਾਈ ਜਾਊਗੀ ਜੀ ਅਤੇ ਮੈਮ ਓਕੇ ਜੀ ਮੈਮ ਇਹ ਹੁਣ ਜਿਹੜੀਆਂ ਮਤਲਬ ਗੇਮਜ਼ ਇਵੈਂਟ ਨੇ ਉਹਨਾਂ ਦੀ ਕੋਈ ਡੇਟ ਵਗੈਰਾ ਫਿਕਸ ਹੈ ਮੈਮ ਜਿਵੇਂ ਮੇਰੀ ਨੌਲੇਜ ਦੇ ਵਿੱਚ ਹੈ ਕਿ ਅਕਤੂਬਰ ਦੇ ਵਿੱਚ ਸ਼ਾਇਦ ਇਹਨਾਂ ਦੀਆਂ ਗੇਮਸ ਸਟਾਰਟ ਹੋ ਰਹੀਆਂ ਨੇ ਡਿਸਟ੍ਰਿਕਟ ਲੈਵਲ ਤੱਕ ਦੀਆਂ ਕਿਉਂਕਿ ਜੋਨ ਲੈਵਲ ਤਾਂ ਇਹਨਾਂ ਦੇ ਜੋਨ ਲੈਵਲ ਦੇ ਵਿੱਚ ਤਾਂ ਬੱਚੇ ਹੈ ਹੀ ਨਹੀਂ ਸੀਗੇ ਤਾਂ ਕਰਕੇ ਇਹ ਸਿਲੈਕਟ ਹੋ ਹੀ ਜਾਂਦੇ ਨੇ ਬੱਚੇ ਤਾਂ ਕੀ ਫਿਰ ਇਹਨਾਂ ਦੀ ਅੱਗੇ ਫਿਰ ਅਸੀਂ ਉਹ ਕੰਟੀਨਿਊ ਕਰਵਾ ਸਕਦੇ ਹਾਂ ਨਾ ਡਿਸਟਰਿਕਟ ਲੈਵਲ 'ਤੇ

ਓਕੇ ਮੈਮ ਥੈਂਕ ਯੂ ਜੀ